ਮੈਂ ਆਪਣੇ ਖੇਤਰ ਦੀਆਂ ਕਲਾ ਕ੍ਰਿਤੀਆਂ ਜਿਵੇਂ ਕਿ ਚਿੱਤਰਕਾਰੀ ਦੀ ਖਰੀਦ ਅਤੇ ਵੇਚ ਆਟ ਗੈਲਰੀਆਂ ਮੇਲਿਆਂ ਅਤੇ ਓਨਲਾਇਨ ਪਲੇਟਫਾਰਮਾਂ ਰਾਹੀਂ ਕਰ ਸਕਦਾ ਹਾਂ ਮੈਨੂੰ ਜਦੋਂ ਵੀ ਕਿਸੇ ਵੀ ਚਿੱਤਰਕਾਰੀ ਦਾ ਖਰੀਦ ਜਾਂ ਵੇਚਣਾ ਯਾਦ ਆਉਂਦਾ ਹੈ ਅਤੇ ਮੈਨੂੰ ਇੱਕ ਕਹਾਣੀ ਵੀ ਨਾਲੇ ਹੀ ਯਾਦ ਆ ਜਾਂਦੀ ਹੈ ਇੱਕ ਬਾਹਰਲੇ ਦੇਸ਼ ਦਾ ਚਿੱਤਰਕਾਰ ਸੀ ਉਹ ਇੱਕ ਗਰੀਬ ਇਸਤਰੀ ਨੂੰ ਮਿਲਿਆ ਉਸ ਗਰੀਬ ਇਸਤਰੀ ਨੂੰ ਵੇਖ ਕੇ ਉਸਨੂੰ ਉਸ 'ਤੇ ਬਹੁਤ ਦਇਆ ਆ ਗਈ ਉਸ ਨੇ ਉਸੇ ਵੇਲੇ ਤੀਹਾਂ ਸੈਕਿੰਡਾਂ ਵਿੱਚ ਇੱਕ ਚਿੱਤਰਕਾਰੀ ਤਿਆਰ ਕੀਤੀ ਅਤੇ ਆਪਣੇ ਸਾਈਨ ਨੀਚੇ ਕਰ ਦਿੱਤੇ ਉਹ ਚਿੱਤਰਕਾਰੀ ਉਸਨੇ ਉਸ ਮਹਿਲਾ ਨੂੰ ਦਿੱਤੀ ਅਤੇ ਕਿਹਾ ਕਿ ਇਸ ਨੂੰ ਜਾ ਕੇ ਇੱਕ ਆਰਟ ਗੈਲਰੀ ਵਿੱਚ ਵੇਚ ਆ ਤੈਨੂੰ ਮੂੰਹ ਮੰਗੀ ਕੀਮਤ ਮਿਲ ਜਾਵੇਗੀ ਉਸਨੇ ਸੋਚਿਆ ਤੀਹ ਸੈਕਿੰਡਾਂ ਵਿੱਚ ਇਹਨੇ ਇੱਕ ਚਿੱਤਰਕਾਰੀ ਮੈਨੂੰ ਬਣਾ ਦਿੱਤੀ ਹੈ ਅਤੇ ਕਹਿੰਦਾ ਇਸ ਨੂੰ ਵੇਚਣ 'ਤੇ ਤੈਨੂੰ ਮੂੰਹ ਮੰਗੀ ਕੀਮਤ ਮਿਲ ਜਾਵੇਗੀ ਉਸਨੇ ਸੋਚਿਆ ਚਲ ਮੈਂ ਕਰਕੇ ਵੇਖ ਲੈਂਦੀ ਹਾਂ ਉਹ ਆਰਟ ਗੈਲਰੀ ਵਿੱਚ ਗਈ ਉਸਨੇ ਕਿਹਾ ਕਿ ਇਸ ਫਲਾ ਲਿਆ ਫਲਾਣੇ ਬੰਦੇ ਨੇ ਫਲਾਣੇ ਫਲਾਣੇ ਬੰਦੇ ਨੇ ਮੈਨੂੰ ਚਿੱਤਰਕਾਰੀ ਬਣਾ ਕੇ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨੂੰ ਵੇਚਣ ਅਤੇ ਮੈਨੂੰ ਮੂੰਹ ਮੰਗੀ ਕੀਮਤ ਮਿਲੇਗੀ ਉਸ ਆਰਟ ਗੈਲਰੀ ਦੇ ਮਾਲਿਕ ਨੇ ਜਦੋਂ ਹੀ ਉਸਦਾ ਨਾਮ ਸੁਣਿਆ ਅਤੇ ਉਸ ਦੇ ਸਿਗਨੇਚਰ ਉਸਦੇ ਹਸਤਾਖਸ਼ਰ ਨੀਚੇ ਚਿੱਤਰਕਾਰੀ 'ਤੇ ਵੇਖੇ ਉਸਨੇ ਕਿਹਾ ਜੋ ਇਸ ਦੀ ਕੀਮਤ ਚਾਹੁੰਦੇ ਹੋ ਉਹ ਕੀਮਤ ਲੈ ਜਾਵੋ ਉਹ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਉਹ ਮੁੜ ਫਿਰ ਉਸੇ ਬੰਦੇ ਕੋਲ ਵਾਪਸ ਆਈ ਜਿਸਨੇ ਉਹ ਚਿੱਤਰਕਾਰੀ ਉਸ ਨੂੰ ਬਣਾ ਕੇ ਦਿੱਤੀ ਸੀ ਉਸਨੇ ਕਿਹਾ ਕਿ ਇਸ ਗੱਲ ਦਾ ਮੈਨੂੰ ਰਾਜ ਦੱਸੋ ਕਿ ਤੀਹ ਸੈਕਿੰਟਾਂ ਵਿੱਚ ਤੁਸੀਂ ਇੱਕ ਚਿੱਤਰਕਾਰੀ ਬਣਾ ਕੇ ਦਿੱਤੀ ਹੈ ਅਤੇ ਉਸ ਦੀ ਕੀਮਤ ਮੂੰਹ ਮੰਗੀ ਹੈ ਉਸ ਚਿੱਤਰਕਾਰ ਨੇ ਕਿਹਾ ਇਸ ਤੀਹ ਸੈਕਿੰਟਾਂ ਪਿੱਛੇ ਦੇਖੋ ਇਹ ਤੀਹ ਸੈਕਿੰਟ ਨਹੀਂ ਮੇਰੀ ਜ਼ਿੰਦਗੀ ਦੇ ਤੀਹ ਸਾਲ ਹਨ ਇਹ ਤੀਹ ਸਾਲਾਂ ਵਿੱਚ ਜੋ ਮੈਂ ਸਿੱਖਿਆ ਹੈ ਹੌਲੀ ਹੌਲੀ ਕਰਕੇ ਸਿੱਖਿਆ ਹੈ ਉਹ ਹੁਣ ਮੈਨੂੰ ਇਸ ਕਾਬਿਲ ਬਣਾ ਚੁੱਕਾ ਹੈ ਕਿ ਉਸਦੀ ਮੈਂ ਤੀਹ ਸਕਿੰਟਾਂ ਵਿੱਚ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰ ਸਕਾਂ ਇਸ ਲਈ ਜਦੋਂ ਵੀ ਕਿਸੇ ਚਿੱਤਰਕਾਰੀ ਦੀ ਖਰੀਦ ਜਾਂ ਵੇਚ ਦੀ ਗੱਲ ਹੁੰਦੀ ਹੈ ਮੈਨੂੰ ਇਹ ਕਿੱਸਾ ਯਾਦ ਯਾਦ ਆ ਜਾਂਦਾ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਧੰਨਵਾਦ